ਅਗਰ ਮੈਂ ਛੋਟੇ ਅਤੇ ਦਰਮਿਆਨੇ ਘਰ ਦੇ ਫੋਮ ਦੀ ਗੱਲ ਕਰਾਂ ਤਾਂ ਸਾਡੇ ਇਲਾਕੇ ਵਿੱਚ ਕੁਛ ਅਜਿਹੇ ਫਾਮ ਹਨ ਜਿਵੇਂ ਕਿ ਕਈਆਂ ਨੇ ਅਚਾਰ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੈ ਇੱਕ ਛੋਟਾ ਜਿਹਾ ਫਾਰਮ ਉਨੀ ਸ਼ੁਰੂ ਕੀਤਾ ਆਪਣੀ ਆਰਥਿਕਤਾ ਲਈ ਅਤੇ ਉਹ ਭਾਈਚਾਰੇ ਲਈ ਵੀ ਬਹੁਤ ਭੂਮਿਕਾ ਨਿਭਾਉਂਦਾ ਹੈ ਭਾਈਚਾਰੇ ਲਈ ਇਸ ਤਰੀਕੇ ਨਾਲ ਭੂਮਿਕਾ ਨਿਭਾਉਂਦਾ ਹੈ ਕਿ ਜਦੋਂ ਜਿਸ ਤਰ੍ਹਾਂ ਉਹਨੀ ਇੱਕ ਆਪਣਾ ਫਾਮ ਸ਼ੁਰੂ ਕੀਤਾ ਹੈ ਆਚਾਰ ਬਣਾਉਣ ਦਾ ਤਾਂ ਉਸ ਵਿੱਚ ਇਲਾਕੇ ਦੇ ਕਾਫੀ ਸਾਰੀਆਂ ਔਰਤਾਂ ਹਨ ਕਾਫੀ ਸਾਰੇ ਲੋਕ ਹਨ ਉਸ ਇਲਾਕੇ ਦੇ ਜੋ ਉਹਨਾਂ ਉਸ ਉਹਨਾਂ ਨਾਲ ਜਾ ਕੇ ਉਹਨਾਂ ਦੇ ਫਾਰਮ ਵਿੱਚ ਜਾ ਕੇ ਕੰਮ ਕਰਦੇ ਹਨ ਜਿਸ ਨਾਲ ਕਿ ਇੱਕ ਭਾਈਚਾਰਾ ਵੀ ਬਣਿਆ ਰਹਿੰਦਾ ਹੈ ਅਤੇ ਇਸ ਉਹਨਾਂ ਨੂੰ ਇੱਕ ਰੋਜ਼ਗਾਰ ਵੀ ਮਿਲਿਆ ਹੋਇਆ ਹੈ ਇਸ ਤਰੀਕੇ ਨਾਲ ਛੋਟੇ ਛੋਟੇ ਫਾਮ ਅਗਰ ਇਹਨਾਂ ਇਲਾ ਕਿਸੇ ਇਲਾਕੇ ਵਿੱਚ ਖੋਲ੍ਹੇ ਜਾਣ ਤਾਂ ਉਹ ਭਾਈਚਾਰੇ ਲਈ ਵੀ ਕਾਫੀ ਭੂਮਿਕਾ ਨਿਭਾਉਂਦੇ ਹਨ